ਮਾਰਕੀਟ ਵਿੱਚ ਬਹੁਤ ਸਾਰੀਆਂ ਕੰਪਨੀਆਂ ਆਪਣੇ ਆਪਣੇ ਟੈਲੀਵਿਜਨ ਵੇਚ ਰਹੀਆਂ ਹਨ

ਜਿਵੇਂ ਕਿ ਵੇਖ ਸਕਦੇ ਹੋ ਸੈਮਸੰਗ ਐਪਲ ਸੈਨਸੁਈ ਟਾਟਾ ਇਹੋ ਜਿਹੇ ਹੋਰ ਬਹੁਤ ਹਨ ਜਿਵੇਂ ਕਿ ਸੈਮਸੰਗ ਇਸ ਉਹ ਹੈ ਇਸ ਦੀ ਵਰੰਟੀ ਵੀ ਪੰਜ ਸਾਲ ਦੀ ਹੈ ਅਤੇ ਇਸ ਨੂੰ ਵੱਧ ਤੋਂ ਵੱਧ ਵਰਤਿਆ ਜਾਣ ਵਾਲਾ ਹੈ ਆਉਣ ਵਾਲੇ ਟਾਈਮ 'ਤੇ ਇਸ ਦੀਆਂ ਕੀਮਤਾਂ ਵਿੱਚ ਵਾਧਾ ਹੀ ਆਵੇਗਾ ਹੁਣ ਦਾ ਇਸਦਾ ਰੇਟ ਦਸ ਹਜ਼ਾਰ ਪੰਜ ਸੌ ਹੈ ਤਾਂ ਕਿ ਤੁਸੀਂ ਇਸ ਨੂੰ ਅੱਜ ਦੇ ਟਾਈਮ ਵਿੱਚ ਖਰੀਦ ਸਕੋ ਅਤੇ ਇਸਦੀ ਮਤਲਬ ਤਮੰਨਾ ਪੂਰੀ ਕਰ ਸਕੋ ਅਤੇ ਆਪਣਾ ਮੰਨੋਰੰਜਕ ਟਾਈਮ ਇਸ ਨਾਲ ਬਤੀਤ ਕਰ ਸਕੋ